ਸਤਿ ਸ਼੍ਰੀ ਅਕਾਲ ਜੀ ਮੇਰਾ ਨਾਂ ਤੇਜਪਾਲਜੀਤ ਸਿੰਘ ਆ ਅਤੇ ਜੇਕਰ ਪੂਰੀ ਦੁਨੀਆਂ ਵਿੱਚ ਮੈਂ ਕਿਸੇ ਤੀਰਥ ਸਥਾਨ ਦੀ ਯਾਤਰਾ ਕਰਨੀ ਹੋਵੇ ਅਤੇ ਉਹ ਮੈਂ ਪਾਕਿਸਤਾਨ ਨਨਕਾਣਾ ਸਾਹਿਬ ਦੀ ਕਰਾਂਗਾ ਜੋ ਕਿ ਸਾਡੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਅਸਥਾਨ ਹੈ ਇਹ ਸਥਾਨ ਨੂੰ ਇਹ ਸਥਾਨ ਨੂੰ ਘੁੰਮਣਾ ਜਾਂ ਇਸ ਸਥਾਨ ਦੀ ਤੀਰਥ ਯਾਤਰਾ ਕਰਨਾ ਮੇਰਾ ਨਿਜੀ ਸਪਨਾ ਹੈ ਕਿਉਂਕਿ ਮੈਂ ਚਾਹੁੰਦਾ ਹਾਂ ਮੈਂ ਇਹ ਜਾਣਨਾ ਚਾਹੁੰਦਾ ਹਾਂ ਕਿ ਕਿੱਥੇ ਸਾਡੇ ਗੁਰੂ ਸਾਹਿਬਾਨ ਦਾ ਜਨਮ ਹੋਇਆ ਜੋ ਕਿ ਸਾਡੇ ਪੰਜਾਬ ਤੋਂ ਦੂਰ ਹੈ ਜਿਸ ਕਰਕੇ ਜਾਣਾ ਬਹੁਤ ਮੁਸ਼ਕਿਲ ਹੈ ਪਰ ਮੇਰਾ ਸਪਨਾ ਹੈ ਕਿ ਮੈਂ ਇੱਕ ਵਾਰੀ ਪਾਕਿਸਤਾਨ ਨਨਕਾਣਾ ਸਾਹਿਬ ਜ਼ਰੂਰ ਜਾਵਾਂ ਤਾਂ ਕਿ ਸਾਨੂੰ ਸਾਡੇ ਇਤਿਹਾਸ ਦਾ ਪਤਾ ਲੱਗੇ ਕਿ ਕਿੱਥੇ ਸਾਡੇ ਗੁਰੂ ਸਾਹਿਬਾਨਾਂ ਦਾ ਜਨਮ ਹੋਇਆ ਅਤੇ ਕਿੱਦਾਂ ਉਹਨਾਂ ਦੀ ਲਾਈਫ ਕਿੱਦਾਂ ਉਹਨਾਂ ਦੀ ਜ਼ਿੰਦਗੀ ਵਿਚਰੀ ਅਤੇ ਇਹੀ ਮੇਰੇ ਜੀਵਨ ਦੀ ਯਾਤਰਾ ਹੈ ਜੇ ਮੈਂ ਉੱਥੇ ਕਦੇ ਜਾ ਪਾਵਾਂ ਅਤੇ ਮੈਂ ਨਨਕਾਣਾ ਸਾਹਿਬ ਜ਼ਰੂਰ ਘੁੰਮ ਕੇ ਆਉਣਾ ਚਾਹਵਾਂਗਾ ਅਤੇ ਹੋਰ ਵੀ ਉਸਦੇ ਲਾਗੇ ਚਾਗੇ ਜੋ ਵੀ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਹਨ ਮੈਂ ਉਹ ਜ਼ਰੂਰ ਘੁੰਮਣੇ ਚਾਹਵਾਂਗਾ ਜੇ ਇਹ ਪੂਰੀ ਮੇਰੀ ਜ਼ਿੰਦਗੀ ਵਿੱਚ ਸੰਭਵ ਹੋਇਆ ਤਾਂ ਮੈਂ ਜ਼ਰੂਰ ਨਨਕਾਣਾ ਸਾਹਿਬ ਇੱਕ ਵਾਰ ਆਪਣੀ ਜ਼ਿੰਦਗੀ ਵਿੱਚ ਘੁੰਮਣ ਜਾਵਾਂਗਾ ਜਿਸ ਨਾਲ ਮੈਨੂੰ ਸੰਤੁਸ਼ਟੀ ਮਿਲੇਗੀ ਅਤੇ ਮੈਨੂੰ ਇਹ ਹੋਵੇਗਾ ਕਿ ਮੈਂ ਆਪਣੇ ਗੁਰੂ ਸਾਹਿਬਾਨਾਂ ਦੇ ਤੀਰਥ ਸਥਾਨਾਂ 'ਤੇ ਘੁੰਮ ਪਾਇਆ ਜੋ ਵੀ ਜੋ ਕਿ ਸਾਡੇ ਲਈ ਬਹੁਤ ਜ਼ਰੂਰੀ ਹੈ ਤਾਂ ਕਿ ਸਾਡੀ ਸਮਾ ਸਮਾਜ ਬਾਰੇ ਸਾਨੂੰ ਦੱਸਦਾ ਹੈ ਅਤੇ ਸਾਡੀ ਇਤਿਹਾਸ ਬਾਰੇ ਸਾਨੂੰ ਦੱਸਦੇ ਕਿ ਗੁਰੂਆਂ ਸਾਡੇ ਗੁਰੂਆਂ ਪੀਰਾਂ ਨੇ ਕਿਸ ਤਰ੍ਹਾਂ ਸਾਨੂੰ ਬਾਹਰੀ ਆਫਤਾਂ ਤੋਂ ਬਚਾਇਆ ਅਤੇ ਸਾਨੂੰ ਸਿੱਖਿਆ ਦਿੱਤੀ ਅਤੇ ਸਾਨੂੰ ਇੱਕ ਚੰਗੀ ਸਿੱਖ ਬਣਾਇਆ ਸਾਨੂੰ ਚੰਗੇ ਇਨਸਾਨ ਬਣਾਇਆ ਇਸ ਲਈ ਪੂਰੀ ਦੁਨੀਆਂ ਵਿੱਚੋਂ ਇੱਕ ਵਾਰ ਸ਼੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਜ਼ਰੂਰ ਜਾਣਾ ਚਾਹਵਾਂਗਾ ਇਹੀ ਮੇਰਾ ਨਿਜੀ ਸਪਨਾ ਹੈ ਅਤੇ ਮੈਂ ਇੱਕ ਵਾਰ ਜ਼ਰੂਰ ਪਾਕਿਸਤਾਨ ਜਾ ਜਾਣਾ ਚਾਹਵਾਂਗਾ ਧੰਨਵਾਦ